ਮੈਂ ਆਪਣੇ ਮੋਆਇਲ ਵੋਲਟ ਵਿੱਚ ਬਕਾਇਆ ਚੈੱਕ ਕਰਨ ਲਈ ਅਤੇ ਆਪਣੇ ਮੋਬਾਈਲ ਫੋਨ ਦੇ ਵਲਟ ਨੂੰ ਦੇਖਣ ਲਈ ਪਹਿਲਾਂ ਉਸ ਐਪ ਉੱਪਰ ਜਾਵਾਂਗੀ ਜਿਸ ਵਿੱਚ ਮੇਰਾ ਅਕਾਊਂਟ ਜਾਂ ਖਾਤਾ ਮੌਜੂਦ ਹੋਵੇਗਾ ਅਤੇ ਫਿਰ ਮੈਂ ਅਕਾਊਂਟ ਖਾਤਾ ਨੂੰ ਲਿ ਕਲਿਕ ਕਰਾਂਗੀ ਅਤੇ ਫਿਰ ਮੈਂ ਅਕਾਊਂਟ ਚੈੱਕ ਆਪਸਨ ਵਿੱਚ ਜਾ ਕੇ ਆਪਣਾ ਪਾਸਵਰਡ ਨਾਲ ਕਾਊਂਟ ਨੰਬਰ ਨੂੰ ਓਪਨ ਕਰਾਂਗੀ ਫਿਰ ਇਸ ਨਾਲ ਮੈਨੂੰ ਆਪਣੇ ਅਕਾਊਂਟ ਵਿੱਚ ਪਏ ਰੁਪਏ ਜਾਂ ਬਕਾਏ ਬਾਰੇ ਪਤਾ ਚੱਲ ਜਾਵੇਗਾ ਅਤੇ ਮੈਂ ਆਪਣੇ ਬਕਾਏ ਦੇ ਅਨੁਸਾਰ ਆਪਣੀ ਆਨਲਾਈਨ ਖਰੀਦਦਾਰੀ ਕਰ ਸਕਦੀ ਹਾਂ ਕਿਉਂਕਿ ਅੱਜ ਕੱਲ੍ਹ ਆਉਣ ਦਾਰੀ ਹੀ ਬਹੁਤ ਹੀ ਮਸ਼ਹੂਰ ਹੈ ਇਸ ਨਾਲ ਬਹੁਤ ਹੀ ਸਾਨੂੰ ਬੈਨੀਫਿਟ ਹੁੰਦਾ ਹੈ ਜੇਕਰ ਇਸ ਤਰੀਕੇ ਰਾਹੀਂ ਮੋਬਾਇਲ ਵਾਲਟ ਐਪ ਵਿੱਚ ਬਕਾਇਆ ਚੈੱਕ ਕਰਨ ਲਈ ਸਮੇਂ ਵਿੱਚ ਕੋਈ ਸਮੱਸਿਆ ਆ ਰਹੀ ਹੋਵੇ ਤਾਂ ਸਾਨੂੰ ਆਪਣੇ ਅਕਾਊਂਟ ਵਿੱਚ ਲੋਗਇਨ ਕਰਨ ਲਈ ਆਪਣੇ ਮੋਬਾਇਲ ਨੰਬਰ ਨੂੰ ਦਰਜ ਕਰਨਾ ਪਵੇਗਾ ਅਤੇ ਫਿਰ ਮੈਸੇਜ ਤੇ ਓ ਟੀ ਪੀ ਆਵੇਗਾ ਫਿਰ ਇਹ ਓ ਟੀ ਪੀ ਭਰਨ ਤੋਂ ਬਾਅਦ ਹੀ ਅਸੀਂ ਆਪਣੇ ਬੜੀ ਆਸਾਨੀ ਨਾਲ ਆਪਣਾ ਅਕਾਊਂਟ ਜਾਂ ਮੋਬਾਈਲ ਵਲਟ ਚੈੱਕ ਆਪਣੇ ਬਕਾਇਆ ਦੇਖ ਸਕਦੇ ਹਾਂ ਜੋ ਕਿ ਸਾਨੂੰ ਬਕਾਇਆ ਬਾਰੇ ਪਤਾ ਲੱਗ ਸਕਦਾ ਹੈ ਕਿ ਸਾਡੇ ਫੋਨ ਜਾਂ ਬੋਲਟ ਵਿੱਚ ਕਿੰਨਾ ਬਕਾਇਆ ਬਾਕੀ ਬਚਿਆ ਹੈ ਅਤੇ ਜ਼ਰੂਰਤ ਅਨੁਸਾਰ ਅਸੀਂ ਇਸ ਨੂੰ ਚੈੱਕ ਕਰ ਸਕਦੇ ਹਾਂ ਤਾਂ ਅਸੀਂ ਸਮੇਂ ਸਮੇਂ 'ਤੇ ਹੀ ਇਸ ਨੂੰ ਚੈੱਕ ਕਰ ਸਕਦੇ ਹਾਂ ਜੋ ਕਿ ਇੱਕ ਆਪਣੇ ਮਸ਼ਹੂਰ ਅਦਾਕਾਰੀ ਨਾਲ ਰਿਲੇਟਡ ਹੁੰਦਾ ਹੈ ਇਸ ਕਰਕੇ ਅਸੀਂ ਆਨਲਾਈਨ ਖਰੀਦਦਾਰੀ ਦੀ ਯੋਜਨਾ ਬਣਾ ਸਕਦੇ ਹਨ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਹੀ ਪ੍ਰਚਲਿਤ ਹਿੱਸਾ ਨਿਭਾਉਂਦੀ ਹੈ